ਹਾਂਜੀ ਸਰ ਹੈਲੋ ਹਾਂਜੀ ਸਰ ਤੁਸੀਂ ਐਡੀਮਿਸਟਰੇਸ਼ਨ ਆਫਿਸ ਤੋਂ ਬੋਲਦੇ ਹੋ ਹਾਂਜੀ ਸਰ ਮੈਂ ਨਾ ਤੁਹਾਨੂੰ ਪੁੱਛਣਾ ਸੀਗਾ ਕਿ ਜਦੋਂ ਮੈਂ ਇੰਟਰਵਿਊ ਦਿੱਤਾ ਸੀਗਾ ਤੇ ਮੈਨੂੰ ਉਹਨਾਂ ਨੇ ਦੱਸਿਆ ਸੀ ਕਿ ਚਾਲੀ ਹਜਾਰ ਰੁਪਏ ਪੇ ਮਿਲੇਗੀ ਤੁਹਾਨੂੰ ਤੇ ਹੁਣ ਜਦੋਂ ਮੈਨੂੰ ਇੰਟਰਵਿਊ ਲੈਟਰ ਆਇਆ ਤੇ ਉਹ ਇੰਟਰਵਿਊ ਲੈਟਰ ਦੇ ਵਿੱਚ ਲਿਖਿਆ ਹੋਇਆ ਕਿ ਤੁਹਾਨੂੰ ਪੈਂਤੀ ਹਜਾਰ ਰੁਪਏ ਮਿਲੇਗੀ ਤੇ ਇਹਦੇ ਬਾਰੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਸਰ ਤੁਸੀਂ ਵੀ ਤਾਂ ਵਿੱਚ ਹੀ ਬੈਠੇ ਹੋਏ ਸੀਗੇ ਤੁਸੀਂ ਵੀ ਨਾਲ ਹੀ ਦੱਸੀ ਸੀਗੀ ਨਹੀ ਨਹੀ ਸਰ ਜਿੰਨੀ ਤੁਸੀਂ ਮੈਨੂੰ ਕਹੀ ਸੀ ਉਨੀ ਪੇ ਤਾਂ ਕਰੋ ਕੰਮ ਸੇ ਕੰਮ ਹਨਾ ਜੋ ਮੇਰੇ ਇੰਟਰਵਿਊ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਇੰਟਰਵਿਊ ਲੈਟਰ 'ਚ ਕੁਝ ਹੋਰ ਕਹਿ ਰਹੇ ਹੋ

ਨਹੀਂ ਨਹੀਂ ਸਰ ਫਿਰ ਇਦਾਂ ਤਾਂ ਮੈਂ ਵਰਕ ਨਹੀਂ ਕਰ ਪਾਵਾਂਗਾ ਤੇ ਜਾਂ ਤਾਂ ਤੁਸੀਂ ਗੱਲ ਕਰੋ ਮੇਰੀ ਪੇ ਵਧਾਓ ਉਨੀ ਕੁ ਕਰਵਾਓ ਜਿੰਨੀ ਹੈਗੀ ਆ ਨਹੀਂ ਤਾਂ ਫਿਰ ਆਈ ਵਿਲ ਨੋ ਡੂ ਦਾ ਵਰਕ ਮੈਂ ਵਰਕ ਨਹੀਂ ਕਰ ਸਕਦਾ ਨਹੀਂ ਨਹੀਂ ਸਰ ਮੈਂ ਬਹੁਤ ਦੂਰ ਰਹਿਦਾ ਸਰ ਮੈਂ ਕਿੱਦਾਂ ਆ ਸਕਦਾ ਮੈਂ ਤੇ ਉੱਥੇ ਕੰਮ ਕਰਨ ਆਉਣਾ ਸੀਗਾ ਕੰਮ ਕਰਨ ਆਉਣਾ ਸੀਗਾ ਸਰ ਮੈਂ ਉੱਥੇ ਦੇਖੋ ਵੀ ਸਰ ਤੁਸੀਂ ਸਰ ਤੁਸੀਂ ਹੀ ਉਹਦੇ ਵਿੱਚ ਬੈਠੇ ਹੋਏ ਸੀ ਤੁਹਾਡੀ ਇੱਕ ਗਰੁੱਪ ਨੇ ਹੀ ਸਲੈਕਟ ਕੀਤਾ ਸੀਗਾ ਮੈਨੂੰ ਮੈਰਿਟ ਤੇ ਸਲੈਕਟ ਹੋਇਆ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਫੋਰਟੀ ਥਾਉਸਾੰਡ ਸੈਲਰੀ ਮਿਲੇਗੀ ਔਰ ਹੁਣ ਜਦੋਂ ਮੇਰਾ ਇੰਟਰਵਿਊ ਲੈਟਰ ਆ ਰਿਹਾ ਕਿ ਮੈਨੂੰ ਉਹਦੇ ਚ ਵੇਖ ਰਿਹਾ ਕਿ ਮੇਰੀ ਪੈਂਤੀ ਹਜਾਰ ਸੈਲਰੀ ਹੈ ਇਹ ਤਾਂ ਫਿਰ ਤੁਸੀਂ ਪ੍ਰੋਬਲਮ ਕੰਮ ਕਰ ਰਹੇ ਹੋ ਨਾ ਨਹੀਂ ਨਹੀਂ ਸਰ ਫਿਰ ਇਹ ਤਾਂ ਗੱਲ ਗਲਤ ਆ ਇਦਾਂ ਨਹੀਂ ਹੋ ਸਕਦਾ ਤੁਸੀਂ ਇਮਪਲੋਈ ਰੱਖੋ ਉਹਨੂੰ ਪੂਰੀ ਸੈਲਰੀ ਦੋ ਨਹੀਂ ਨਹੀਂ ਸਰ ਫਿਰ ਮੈਂ ਕੰਮ ਨਹੀਂ ਕਰ ਸਕਦਾ ਨਹੀਂ ਨਹੀਂ ਸਰ ਮੈਂ ਕੰਮ ਨਹੀਂ ਕਰ ਸਕਦਾ ਚਲੋ ਠੀਕ ਕੋਈ ਗੱਲ ਨਹੀਂ ਥੈਂਕ ਯੂ ਓਕੇ ਓਕੇ